ਭਈ ਮੈਂ ਰੇਲ ਗੱਡੀ ਰਾਹੀਂ ਆਹਾ ਜੂਨ ਦੀ ਛੁੱਟੀਆਂ 'ਚ ਗਈ ਸੀਗੀ ਰਾਜਸਥਾਨ ਤਾਂ ਬੀ ਸੀਟਾਂ ਦੇਖੋ ਸੀਟਾਂ ਵਧੀਆ ਹੁੰਦੀਆਂ ਆ ਹੁੰਦਾ ਕੀ ਜਿਵੇਂ ਫਸਟ ਕਲਾਸ ਹੈ ਓਹਦੇ ਤਾਂ ਸੀਟਾਂ ਵਾਵਾ ਵਧੀਆ ਬਈ ਜਿਵੇਂ ਆਪਣਾ ਬ ਆਹਾ ਚਾਰ ਫੁੱਟਾ ਬੈਡ ਨਹੀਂ ਹੁੰਦਾ ਓਹੋ ਜਿਹੀ ਉਹਦੀਆਂ ਸੀਟਾਂ ਹੁੰਦੀਆਂ ਆ ਤਾਂ ਜੇ ਸੈਕੰਡ ਕਲਾਸ ਆ ਉਹਦੀ ਸੀਟਾਂ ਥੋੜ੍ਹੀਆਂ ਘੱਟ ਤਾਂ ਥਰਡ ਦੀ ਓਹ ਤੋਂ ਘੱਟ ਵਧੀਆ ਹੁੰਦੀਆਂ ਠੀਕ ਹੈ ਇਸ ਲਈ ਮਤਲਬ ਬਰਥ ਜਿਹੜੀ ਹੁੰਦੀ ਨਾ ਓਹਦੀ ਵਧੀਆ ਹੀ ਹੁੰਦੀ ਆ ਫਿਰ ਇਹਦਾ ਜਿਹੜਾ ਇੰਜਣ ਆ ਬਾਈ ਮਜ਼ਾ ਆ ਜਾਂਦਾ ਇੰਜਣ ਵੱਡਾ ਸਾਰਾ ਹੁੰਦਾ ਕੂਕਾਂ ਮਾਰਦਾ ਇੰਜਣ ਆਉਂਦਾ ਆ ਤਾਂ ਇਹਦੇ ਵਿੱਚ ਜਿਹੜੇ ਪਹੀਏ ਹੁੰਦੇ ਆ ਇੰਨੇ ਮਜਬੂਤ ਲੋਹੇ ਦੇ ਪਹੀਏ ਹੁੰਦੇ ਆ ਠੀਕ ਹੈ ਉਹ ਪਹੀਏ ਜਿਹੜੇ ਉਹ ਟਰੈਕ 'ਤੇ ਚਲਦੇ ਹੁੰਦੇ ਆ ਗੱਡੀ ਉਹਨਾਂ ਟਰੈਕ ਦੇ ਉੱਤੇ ਚੱਲ ਰਹੀ ਜੇ ਉਹ ਟਰੈਕ ਨਾ ਸਹੀ ਹੋਣ ਅਤੇ ਐਕਸੀਡੈਂਟ ਦੇ ਕਾਰਨ ਬਣ ਜਾਂਦੇ ਆ ਅਤੇ ਸ਼ੋਰ ਸ਼ਰਾਬਾ ਪਾਉਂਦੀ ਗੱਡੀ ਜਦ ਕੂਕਾਂ ਮਾਰਦੀ ਜਾਂਦੀ ਦੂਰ ਦੂਰ ਥਾਈਂ ਪਤਾ ਚਲਦਾ ਵੀ ਰੇਲ ਗੱਡੀ ਆ ਰਹੀ ਆ ਹੁਣ ਜਿਹੜਾ ਇੰਜਣ ਹੈ ਇੰਜਣ ਹੀ ਸਾਰੀ ਰੇਲ ਦੀ ਜਾਨ ਹੈ ਕਿਉਂਕਿ ਇਹੀ ਖਿੱਚ ਕੇ ਇਹਨੂੰ ਲੈ ਕੇ ਜਾਂਦਾ ਹੈ ਬਾਈ ਇੰਨੇ ਡੱਬੇ ਹੁੰਦੇ ਆ ਠੀਕ ਹੈ ਤਾਂ ਇਸ ਕਰਕੇ ਜਿਹੜੀ ਰੇਲ ਆ ਯਾਤਰਾ ਉਹ ਤਾਂ ਹੈ ਤਾਂ ਬੜੀ ਮਜ਼ੇਦਾਰ ਹੁੰਦੀ ਆ ਇੱਕ ਥਾਂ ਤੋਂ ਦੂਜੇ ਥਾਂ ਲਿਜਾਣ 'ਚ ਸਾਰਿਆਂ ਤੋਂ ਜਿਹੜੀ ਸਸਤੀ ਹੈ ਉਹ ਰੇਲ ਪੈਂਦੀ ਹੈ ਸਾਨੂੰ ਤਾਂ ਸਾਡਾ ਜਿਹੜਾ ਸਰਕਾਰ ਹੈ ਉਹ ਵੀ ਸਾਨੂੰ ਆਮ ਜਿਹੇ ਪੈਸਿਆਂ ਦੇ ਵਿੱਚ ਰੇਲ ਯਾਤਰਾ ਕਰਾ ਦਿੰਦੀ ਹੈ